ਯੋਗਾ ਆਰਾਮ ਨੂੰ ਉਤਸ਼ਾਹਿਤ ਕਰਨ ਅਤੇ ਤਣਾਅ ਨੂੰ ਘਟਾ ਕੇ ਨੀਂਦ ਦੇ ਪੈਟਰਨਾਂ ਰਣਾ ਅਤੇ ਸਮੁੱਚੀ ਨੀਂਦ ਦੀ ਗੁਣਵੱਤਾ ਨੂੰ ਮਹੱਤਵਪੂਰਨ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ ਇੱਕ ਰੂਟੀਨ ਵਿੱਚ ਖਾਸ ਯੋਗਾ ਅਭਿਆਸਾਂ ਅਤੇ ਤਕਨੀਕਾਂ ਨੂੰ ਸ਼ਾਮਿਲ ਕਰਨਾ ਵਧੇਰੇ ਆਰਾਮਦਾਇਕ ਨੀਂਦ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ ਕੋਮਲ ਬਹਾਲ ਕਰਨ ਵਾਲੇ ਪੋਜ ਜਿਵੇਂ ਚਾਇਲਡਜ ਪੋਜ ਲੈਗਜ ਐਪ ਦੀਵਾਲ ਪੋਜ ਸੁਕਤਾਬਦਾ ਕੋਨਾਸਨ ਨਰਵਸ ਸਿਸਟਮ ਨੂੰ ਸ਼ਾਂਤ ਕਰਨ ਅਤੇ ਸਰੀਰ ਨੂੰ ਨੀਂਦ ਲਈ ਤਿਆਰ ਕਰਨ ਵਿੱਚ ਮਦਦ ਕਰਦੇ ਹਨ ਇਸ ਤੋਂ ਇਲਾਵਾ ਪ੍ਰਿਆਮ ਵਰਗੇ ਡੂੰਘੇ ਸਾਹ ਲੈਣ ਦੇ ਅਭਿਆਸਾਂ ਦਾ ਯਤਨ ਕਰਨਾ ਆਰਾਮ ਨੂੰ ਵਧਾ ਸਕਦਾ ਹੈ ਕੋਰੀ ਕੋਰੀਸਟਰੋਲ ਦੇ ਪੱਧਰ ਨੂੰ ਘਟਾ ਸਕਦਾ ਹੈ ਜੋ ਬਦਲੇ ਵਿੱਚ ਸੌਣ ਵਿੱਚ ਆਸਾਨੀ ਨਾਲ ਮਦਦ ਕਰ ਸਕਦਾ ਹੈ ਧਿਆਨ ਅਤੇ ਧਿਆਨ ਜੋ ਅਕਸਰ ਯੋਗ ਅਭਿਆਸ ਵਿੱਚ ਸ਼ਾਮਿਲ ਹੁੰਦੇ ਹਨ ਮਾਨਸਿਕ ਵਿਕਾਸ ਨੂੰ ਘਟਾਉਣ ਵਿੱਚ ਮਦਦ ਕਰ ਕਰਦੇ ਹਨ ਨੀਂਦ ਵਿੱਚ ਵਿਗ ਵਿਘਨ ਪਾ ਸਕਦੇ ਹਨ ਪ੍ਰਗਤੀਸ਼ੀਲ ਮਾਸਪੇਸ਼ੀਆਂ ਆਰਾਮ ਵਰਗੀਆਂ ਤਕਨੀਕਾਂ ਜਿਵੇਂ ਵਿਵਸਥਿਤ ਤੌਰ 'ਤੇ ਤਣਾਅ ਕਰਦੇ ਹੋ ਫਿਰ ਹਰੇਕ ਮਾਸਪੇਸ਼ੀ ਸਮੂਹ ਨੂੰ ਆਰਾਮ ਦਿੰਦੇ ਹੋ ਸਰੀਰਕ ਆਰਾਮ ਨੂੰ ਵੀ ਉਤਸ਼ਾਹਿਤ ਕਰ ਸਕਦੇ ਹਨ ਨੀਂਦ ਵਿੱਚ ਤਬਦੀਲੀ ਨੂੰ ਆਸਾਨ ਕਰ ਸਕਦੇ ਹਨ ਇੱਕ ਨਿਰੰਤਰ ਸ਼ਾਮ ਦੀ ਰੁਟੀਨ ਜਿਸ ਵਿੱਚ ਇਹਨਾਂ ਤੱਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਇੱਕ ਸ਼ਾਂਤਮਈ ਪ੍ਰੀ ਸਲੀਪ ਰੀਤੀ ਰਿਵਾਜ ਬਣਾ ਸਕਦਾ ਹੈ ਜੋ ਤੁਹਾਡੇ ਸਰੀਰ ਨੂੰ ਸੰਕੇਤ ਦਿੰਦਾ ਹੈ ਕਿ ਇਹ ਸਮਾਂ ਖਤਮ ਹੁੰਦਾ ਹੈ ਕੁੱਲ ਮਿਲਾ ਕੇ ਯੋਗਾ ਨੂੰ ਇੱਕ ਰਾਤ ਦੀ ਰੂਟੀਨ ਵਿੱਚ ਜੋੜਨਾ ਸਰੀਰਕ ਤਣਾਅ ਅਤੇ ਮਾਨਸਿਕ ਤਣਾਅ ਦੋਵਾਂ ਨੂੰ ਸੰਬੋਧਨ ਕਰਕੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਸਕਦਾ ਹੈ